ਸਤਿ ਸ਼੍ਰੀ ਅਕਾਲ ਰਮਨਪ੍ਰੀਤ ਕੌਰ ਪਠਾਨਕੋਟ ਤੋਂ ਗੱਲ ਕਰਦੀ ਪਈ ਹਾਂ ਜਿਵੇਂ ਕਿ ਅਸੀਂ ਆਪਣੇ ਬਚਪਨ ਦੇ ਵਿੱਚ ਸਕੂਲ ਟਰਿਪ ਅਸੀਂ ਸਕੂਲ ਜਿਹੜੀ ਕਾਲਜ ਯਾਤਰਾ ਵਿੱਚ ਅਸੀਂ ਮੈਂ ਆਪਣੇ ਕਾਲਜ ਯਾਤਰਾ ਵਿੱਚ ਹਰਿਮੰਦਰ ਸਾਹਿਬ ਫਿਰ ਹਰਿਮੰਦਰ ਸਾਹਿਬ ਵੰਡਰਲੈਂਡ ਇਹ ਦੋ ਥਾਵਾਂ ਉੱਤੇ ਗਈ ਸੀ ਇੱਕ ਸਨ ਸਿਟੀ ਵੀ ਗਈ ਸੀ ਮੈਂ ਆਪਣੇ ਮਤਲਬ ਕਿ ਸਕੂਲ ਅਤੇ ਕਾਲਜ ਦੀ ਜਿਹੜੀ ਯਾਤਰਾ ਸੀ ਉਹਨਾਂ ਵੱਲੋਂ ਜਿਹੜੀ ਹਰਿਮੰਦਰ ਸਾਹਿਬ 'ਚ ਸੀ ਉੱਥੇ ਆਪਾਂ ਜਾ ਕੇ ਅਤੇ ਉੱਥੇ ਆਪਾਂ ਮੱਥਾ ਟੇਕਿਆ ਸੀ ਅਸੀਂ ਆਪਣੇ ਸਾਰੇ ਸਕੂਲ ਦੇ ਬੱਚਿਆਂ ਦੇ ਨਾਲ ਮੈਂ ਗਈ ਸੀ ਉੱਥੇ ਸਾਡੰਕ ਫਾਸਟ ਟੀਚਰਸ ਵੀ ਗਏ ਸੀ ਅਸੀਂ ਦੋ ਬੱਸਾਂ ਗਈਆਂ ਸੀ ਉੱਥੇ ਅਸੀਂ ਉੱਥੇ ਬਹੁਤ ਹੀ ਮਲਤਬ ਕਿ ਜਿੱਦਾਂ ਆਪਾਂ ਉੱਥੇ ਜਾ ਜਾ ਰਹੇ ਸੀ ਅੰਮ੍ਰਿਤਸਰ ਵੱਲ ਆਪਾਂ ਉੱਥੇ ਆਪਸ 'ਚ ਆਪਣੇ ਦੋਸਤਾਂ ਨੂੰ ਬਹੁਤ ਮਜ਼ਾ ਕੀਤਾ ਬਹੁਤ ਸਾਰਾ ਇੰਜੋਏ ਕੀਤਾ ਫਿਰ ਅਸੀਂ ਕਾਫੀ ਕੁਛ ਉੱਥੇ ਖਾਧਾ ਵੀ ਅਸੀਂ ਫਿਰ ਕਾਫੀ ਮਤਲਬ ਕੁਛ ਖਾਣਾ ਨੂੰ ਅਸੀਂ ਘਰੋਂ ਵੀ ਨਾਲ ਆਪਣੇ ਲੈ ਕੇ ਗਏ ਸੀ ਉੱਥੇ ਆਪਣੇ ਸਾਡੇ ਦੋਸਤੋਂ ਵੀ ਘਰੋਂ ਆਪਣੇ ਲੈ ਕੇ ਆਏ ਸੀ ਇਹ ਸਾਰਾ ਉੱਥੇ ਮਿਲ ਕੇ ਆਪਣੇ ਟੀਚਰਸ ਦੇ ਨਾਲ ਬੈਠ ਕੇ ਆਪਾਂ ਫਰੈਂਡਸ ਨਾਲ ਬੈਠ ਕੇ ਖਾਧਾ ਫਿਰ ਅਸੀਂ ਆਪਣੇ ਮਤਲਬ ਕਿ ਉਹ ਸੀਟ ਪਰ ਪਹੁੰਚ ਕੇ ਆਪਾਂ ਹਰਿਮੰਦਰ ਸਾਹਿਬ ਪਹੁੰਚ ਕੇ ਉੱਥੇ ਆਪਾਂ ਲਾਈਨ 'ਚ ਲੱਗ ਗਏ ਅਤੇ ਆਪਾਂ ਮੱਥਾ ਟੇਕਿਆ ਫਿਰ ਮੈਂ ਸਾਰੇ ਬਾਹਰੋਂ ਵੀ ਅਸੀਂ ਕਾਫੀ ਚੀਜ਼ਾਂ ਖਾਧੀਆਂ ਅਸੀਂ ਆਪਣੇ ਘਰੋਂ ਪੈਸੇ ਵੀ ਫੜੇ ਸੀ ਤਾਂ ਅਸੀਂ ਬਹੁਤ ਜ਼ਿਆਦਾ ਚੀਜ਼ਾ ਅਸਾਂ ਖਾਧੀਆਂ ਫਿਰ ਉੱਥੇ ਅਸੀਂ ਵੰਡਰਲੈਂਡ ਗਏ ਸੀ ਵੰਡਰਲੈਂਡ ਵੀ ਉੱਥੇ ਸਾਰੇ ਬਹੁਤ ਮਤਲਬ ਕਿ ਅਸੀਂ ਪਾਣੀ ਵਿੱਚ ਕਾਫੀ ਜ਼ਿਆਦਾ ਪਾਣੀ ਵਿੱਚ ਕਾਫੀ ਜ਼ਿਆਦਾ ਮਜ਼ਾ ਕੀਤਾ ਅਤੇ ਵੋਟਿੰਗ ਕੀਤੀ ਅਤੇ ਅਸੀਂ ਉਹਦੇ 'ਚ ਪਾਣੀ 'ਚ ਸਵੀਵਿੰਗ ਵੀ ਕੀਤੀ ਉੱਥੇ ਆਪਾਂ ਕਾਫੀ ਐਨ ਵੰਡਰਲੈਂਡ ਵੀ ਕਾਫੀ ਇੰਜੋਏ ਕੀਤਾ ਨਾਲ ਅਸੀਂ ਫਰੈਂਡਸ ਨਾਲ ਕਾਫੀ ਸਾਰੀ ਫੋਟੋਸ ਖਿੱਚੀਆਂ ਕਾਫੀ ਵੀਡੀਓਜ਼ ਵੀ ਇੱਥੇ ਬਣਾਈਆਂ ਆਪਾਂ ਅਸੀਂ ਆਪਣੇ ਟੀਚਰਸ ਨਾਲ ਕਾਫੀ ਮਜ਼ਾ ਵੀ ਕੀਤਾ ਔਰ ਉਹਨਾਂ 'ਤੇ ਪਾਣੀ ਵੀ ਡਾਲਿਆ ਡਾਂਟ ਵੀ ਪਈ ਉੱਥੇ ਸਾਨੂੰ ਫਿਰ ਅਸੀਂ ਕਾਫੀ ਮਜ਼ਾ ਉੱਥੇ ਵੀ ਕੀਤਾ ਫਿਰ ਅਸੀਂ ਸਨ ਸਿਟੀ ਵੀ ਆਪਾਂ ਗਏ ਅਤੇ ਉੱਥੇ ਵੀ ਆਪਾਂ ਮਤਲਬ ਕਿ ਕਾਫੀ ਉੱਥੇ ਕੁਛ ਦੇਖਿਆ ਵੀ ਕਾਫੀ ਕੁਛ ਸਮਝਿਆ ਵੀ ਉੱਥੇ ਦੇ ਕਾਫੀ ਕੁਛ ਉੱਥੇ ਆਪਣੇ ਮਤਲਬ ਕਿ ਕਾਫੀ ਕੁਛ ਖਾਧਾ ਪੀਤਾ ਇੰਜੋਏ ਕੀਤਾ ਅਤੇ ਆਪਣੇ ਫਰੈਂਡਸ ਦੇ ਨਾਲ ਕਾਫੀ ਸਾਨੂੰ ਮਤਲਬ ਮਜ਼ਾ ਵੀ ਅਸੀਂ ਕੀਤਾ ਅਤੇ ਕਾਫੀ ਮੇਰੀ ਮਤਲਬ ਕਿ ਉਹ ਕ ਕਾਫੀ ਵਧੀਆ ਜਿਹੀ ਯਾਦ ਬਣ ਗਈ ਹੈ